ਸਾਨੂੰ ਮਨਿਸਟਰੀ ਨੂੰ ਇੱਕ ਰਿਪੋਰਟ ਭੇਜਣੀ ਸੀਗੀ ਰਿਪੋਟ ਦੇ ਅੰਦਰ ਸਾਨੂੰ ਇਹ ਦੱਸਣਾ ਸੀਗਾ ਸਾਡੇ ਕਾਲਜ ਵਿੱਚ ਕਿਹੜੇ ਕਿਹੜੇ ਕੋਰਸ ਪੜ੍ਹਾਏ ਜਾਂਦੇ ਨੇ ਅਤੇ ਇਸ ਵਿੱਚ ਕਿੰਨੇ ਕਿੰਨੇ ਬੱਚੇ ਪੜ੍ਹ ਰਹੇ ਹੈਗੇ ਇਹ ਰਿਪੋਰਟ ਸਾਨੂੰ ਮੰਗਲਵਾਰ ਦੀ ਸ਼ਾਮ ਪੰਜ ਵਜੇ ਤੱਕ ਤਿਆਰ ਕਰ ਕੇ ਮਨਿਸਟਰੀ ਨੂੰ ਭੇਜਣਾ ਸੀਗਾ ਮੈਨੂੰ ਮੇਰੇ ਸੀਨੀਅਰ ਅਫ਼ਸਰ ਨੇ ਸੋਮਵਾਰ ਦੀ ਸ਼ਾਮ ਤੱਕ ਦਾ ਸਮਾਂ ਦਿੱਤਾ ਸੀਗਾ ਕਿ ਮੈਂ ਇਹਦੀ ਰਿਪੋਰਟ ਤਿਆਰ ਕਰਕੇ ਉਹਨਾਂ ਨੂੰ ਇਹਦੀ ਕਾਪੀ ਦੇ ਦੇਵਾਂ ਸੋਮਵਾਰ ਨੂੰ ਛੇਤੀ ਜਾਣ ਕਰਕੇ ਮੈਂ ਇਹ ਰਿਪੋਰਟ ਤਿਆਰ ਨਹੀਂ ਕਰ ਪਾਇਆ ਮੈਂ ਸੋਚਿਆ ਸੀਗਾ ਕਿ ਮੈਂ ਮੰਗਲਵਾਰ ਸਵੇਰੇ ਸਰ ਨੂੰ ਰਿਪੋਰਟ ਦੇ ਦੇਵਾਂਗਾ ਅਤੇ ਉਹ ਉਹਨੂੰ ਚੈੱਕ ਕਰ ਕੇ ਮਨਿਸਟਰੀ ਨੂੰ ਭੇਜ ਦੇਣਗੇ ਮੰਗਲਵਾਰ ਸਵੇਰੇ ਮੀਂਹ ਪੈਣ ਦੇ ਕਰਕੇ ਮੈਂ ਦਫ਼ਤਰ ਆਉਣ ਨੂੰ ਲੇਟ ਹੋ ਗਿਆ ਦਫ਼ਤਰ ਆਉਂਦੇ ਹੀ ਮੇਰੇ ਅਫ਼ਸਰ ਮੇਰੇ 'ਤੇ ਬੜਾ ਗੁੱਸਾ ਹੋਏ ਕਿ ਰਿਪੋਰਟ ਕਿਉਂ ਨਹੀਂ ਤਿਆਰ ਹੈ ਮੈਂ ਉਹਨਾਂ ਤੋਂ ਇੱਕ ਘੰਟੇ ਦਾ ਸਮਾਂ ਮੰਗਿਆ ਅਤੇ ਫਟਾ ਫਟ ਬਹਿ ਕੇ ਸਾਰਾ ਡਾਟਾ ਪ੍ਰਾਪਤ ਕਰਕੇ ਰਿਪੋਰਟ ਵਧੀਆ ਜਿਹੀ ਬਣਾ ਕੇ ਉਹਨੂੰ ਦੇ ਦਿੱਤੀ ਰਿਪੋਰਟ ਦੇਖ ਕੇ ਉਹ ਬਹੁਤ ਖੁਸ਼ ਹੋ ਗਏ ਅਤੇ ਅਸੀਂ ਸਮੇਂ ਨਾਲ ਉਹ ਰਿਪੋਰਟ ਮਨਿਸਟਰੀ ਨੂੰ ਭੇਜ ਦਿੱਤੀ